ਹੈਲੋ ਮੇਰੀ ਗੱਲ ਮੀਸ਼ੋ ਨਾਲ ਹੋ ਰਹੀ ਹੈ ਮੈਂ ਮੀਸ਼ੋ ਤੋਂ ਨਾ ਇੱਕ ਵ ਹੇਅਰ ਸਟੇਟਨਰ ਜਿਹੜਾ ਔਡਰ ਕੀਤਾ ਸੀਗਾ ਅਤੇ ਮੈਂ ਆਪਣਾ ਉਸ ਦੇ ਨਾਲ ਜਿਹੜਾ ਐਕਸਪੀਰੀਅੰਸ ਮੇਰਾ ਰਿਹਾ ਵਾ ਮੈਂ ਉਹਦੇ ਬਾਰੇ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਇਹ ਔਡਰ ਕੀਤਾ ਹੇਅਰ ਸਟੇਟਨਰ ਤਾਂ ਬਿਲਕੁਲ ਉਹੀ ਚੀਜ਼ ਆਈ ਜੋ ਕਿ ਇੱਕ ਐਪ ਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਗਿਆ ਸੀਗਾ ਕਿ ਇਹਦਾ ਕਲਰ ਬਹੁਤ ਵਧੀਆ ਆ ਇਹਦਾ ਟੈਂਪਰੇਚਰ ਕਿੰਨਾ ਆ ਜਾਂ ਇਹ ਮਤਲਬ ਸਟੇਟਨਰ ਦੇ ਨਾ ਸਟੇਟਨਿੰਗ ਕਰਨ ਦੇ ਨਾਲ ਨਾਲ ਜਿਹੜਾ ਇਹ ਕਰਲ ਵੀ ਪਾਉਂਦਾ ਆ ਅਤੇ ਜਿਹੜਾ ਜਿਸ ਤਰ੍ਹਾਂ ਮੈਂ ਵੇਖਿਆ ਸੀਗਾ ਇੱਕ ਵੈਬਸਾਈਟ ਦੇ ਉੱਪਰ ਅਤੇ ਉਸੇ ਤਰ੍ਹਾਂ ਹੀ ਸੇਮ ਜਿਹੜਾ ਵਾ ਪ੍ਰੋਡਕਟ ਮੈਨੂੰ ਰਿਸੀਵ ਹੋਇਆ ਵਾ ਅਤੇ ਇਹਦਾ ਜਿਹੜੀ ਆ ਚਾਰਜਿੰਗ ਜਿਹੜੀ ਆ ਬਹੁਤ ਵਧੀਆ ਆ ਕਾਫੀ ਟਾਈਮ ਤੱਕ ਇਹ ਨੂੰ ਇੱਕ ਵਾਰੀ ਲਗਾਉਣ ਦੇ ਨਾਲ ਜਿਹੜਾ ਵਾ ਚਾਰਜ ਕਰਨ ਤੋਂ ਬਾਅਦ ਜਿਹੜਾ ਆਪਾਂ ਯੂਜ਼ ਕਰ ਸਕਦੇ ਹਾਂ ਅਤੇ ਇਹ ਵੈਸੇ ਤਾਂ ਇਲੈਕਟਰੀਕਲ ਜਿਹੜਾ ਡਿਵਾਈਸ ਆ ਅਗਰ ਆਪਾਂ ਇਹ ਨੂੰ ਰਿਮੂਵ ਵੀ ਕਰ ਦਾਂਗੇ ਸਵਿਚ ਔਫ ਵੀ ਕਰ ਦਾਂਗੇ ਤਾਂ ਕਾਫੀ ਤ ਟਾਈਮ ਤੱਕ ਜਿਹੜਾ ਇਹ ਜਿਹੜਾ ਵਾ ਕਿ ਮਤਲਬ ਗਰਮ ਰਹਿੰਦਾ ਆ ਅਤੇ ਬਹੁਤ ਹੀ ਵਧੀਆ ਜਿਹੜੀ ਇੱਕ ਸ਼ਾਈਨ ਆਉਂਦੀ ਜਦੋਂ ਵੀ ਆਪਾਂ ਇਸ ਨੂੰ ਯੂਜ਼ ਕਰਦੇ ਹਾਂ ਅਤੇ ਪ੍ਰੋਪਰਲੀ ਜਿਹੜੇ ਆਪਣੇ ਵਾਲ ਆ ਉਹਨਾਂ ਵਿੱਚ ਇਹੋ ਜਿਹੀ ਛਾਈਨ ਆਉਂਦੀ ਹੈ ਕਿ ਆਪਾਂ ਨੂੰ ਯਕੀਨ ਨਹੀਂ ਹੁੰਦਾ ਕਿ ਆਪਾਂ ਜਾਂ ਸੈਲੂਨ ਤੋਂ ਕਰਵਾਏ ਆ ਜਾਂ ਆਪਾਂ ਘਰ ਬੈਠ ਕੇ ਕਰ ਚੁੱਕੇ ਹਾਂ ਅਤੇ ਪ੍ਰੋਡਕਟ ਦੀ ਕੁਆਲਿਟੀ ਐਡੀ ਵਧੀਆ ਆ ਕਿ ਕੋਈ ਵੀ ਜ਼ਿਆਦਾ ਇਹ ਹਾਮਫੁਲ ਨਹੀਂ ਜ਼ਿ ਜਾਂ ਕੋਈ ਸ਼ੋਟ ਸਰਕਿਟ ਦਾ ਕੋਈ ਵੀ ਇਹਦੇ ਵਿੱਚ ਡਰ ਨਹੀਂ ਹੁੰਦਾ ਨਹੀਂ ਤਾਂ ਅਦਰਵਾਈਜ਼ ਹੁੰਦਾ ਆ ਕਿ ਕਈ ਵਾਰੀ ਆਪਾਂ ਕੋਈ ਇਲੈਕਟਰੀਕਲ ਪ੍ਰੋਡਕਟ ਖਰੀਦਦੇ ਹਾਂ ਅਤੇ ਉਹਨਾਂ ਦੀ ਮਤਲਬ ਸ਼ੌਕ ਲੱਗਣ ਦਾ ਮਤਲਬ ਹੋ ਜਾਂਦਾ ਵਾ ਪਰ ਇਹ ਇਸ ਪ੍ਰੋਡਕਟ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਸੀ ਮੈਨੂੰ ਇਹ ਪ੍ਰੋਡਕਟ ਵਰਤਣ ਨਾਲ ਬਹੁਤ ਹੀ ਜ਼ਿਆਦਾ ਜਿਹੜੇ ਬੈਨੀਫਿਟ ਹੋਏ ਨੇ ਅਤੇ ਇਹ ਪ੍ਰੋਡਕਟ ਇੰਨਾ ਵਧੀਆ ਕਿ ਇਹਦੇ ਨਾਲ ਆਪਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਨਾਲ ਆਪਾਂ ਸਟਰੇਟ ਕਰਨ ਦੇ ਨਾਲ ਨਾਲ ਜਿਹੜੇ ਆਪਣੇ ਹੇਅਰ ਦੇ ਉੱਤੇ ਕਰਲ ਵੀ ਪਾ ਸਕਦੇ ਹਾਂ ਅਤੇ ਉਹ ਵੀ ਕਾਫੀ ਟਾਈਮ ਤੱਕ ਟਿਕਦੇ ਆ ਜਦੋਂ ਕਿ ਦੂਸਰੇ ਜਿਹੜੇ ਆਪਾਂ ਯੂਜ਼ ਕਰੀਏ ਪਾਰਲਰ ਤੋਂ ਕਰਵਾਈਏ ਉਹ ਇੰਨਾ ਟਾਈਮ ਨਹੀਂ ਕੱਢਦੇ ਹੈਗੇ ਤਾਂ ਇਸ ਕਰਕੇ ਮੇਰਾ ਐਕਸਪੀਰੀਅੰਸ ਜਿਹੜਾ ਵਾ ਅ ਹੇਅਰ ਸਟੇਟਨਰ ਦੇ ਨਾਲ ਜਿਹੜਾ ਬਹੁਤ ਵਧੀਆ ਰਿਹਾ ਆ ਥੈਂਕ ਯੂ